ਜੇਕਰ ਆਪਾਂ ਦੌੜਨ ਦੀ ਗੱਲ ਕਰੀਏ ਤਾਂ ਦੌੜਨਾ ਮਨੁੱਖੀ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਦੌੜਨ ਨਾਲ ਸਰੀਰ ਵਿੱਚ ਤੰਦਰੁਸਤੀ ਅਤੇ ਫੁਰਤੀ ਆਉਂਦੀ ਹੈ ਇਸ ਨਾਲ ਸਰੀਰ ਮਾਨਸਿਕ ਤੌਰ 'ਤੇ ਵੀ ਹੈ ਅਤੇ ਸਰੀਰਕ ਤੌਰ 'ਤੇ ਵੀ ਤੰਦਰੁਸਤ ਰਹਿੰਦਾ ਹੈ ਜੇਕਰ ਆਪਾਂ ਵੱਖ ਵੱਖ ਮੌਸਮੀ ਸਥਿਤੀ ਦੇ ਵਿੱਚ ਦੌੜਨ ਦੇ ਕੁਝ ਸੁਝਾਅ ਦੱਸੀਏ ਤਾਂ ਕੁਝ ਇਸ ਪ੍ਰਕਾਰ ਹਨ ਜੇਕਰ ਆਪਾਂ ਠੰਢ ਵਿੱਚ ਦੌੜੀਏ ਤਾਂ ਆਪਾਂ ਨੂੰ ਠੰਢ ਵਿੱਚ ਦੌੜਨ ਸਮੇਂ ਗਰਮ ਕੱਪੜੇ ਪਹਿਨਣੇ ਚਾਹੀਦੇ ਆ ਸਰੀਰ ਨੂੰ ਪੂਰੀ ਤਰ੍ਹਾਂ ਗਰਮ ਰੱਖਣਾ ਚਾਹੀਦਾ ਜੇ ਆਪਾਂ ਨੂੰ ਦੌੜਨ ਤੋਂ ਪਹਿਲਾਂ ਸਟਰੈਚਿੰਗ ਕਰਨੀ ਚਾਹੀਦੀ ਜਿਸ ਨਾਲ ਸਰੀਰ ਗਰਮ ਰਹੇ ਜੇਕਰ ਜ਼ਿਆਦਾ ਠੰਢ ਹੋਵੇ ਤਾਂ ਸਾਨੂੰ ਦੌੜਨਾ ਹਟ ਛੱਡ ਦੇਣਾ ਚਾਹੀਦਾ ਜੇਕਰ ਆਪਾਂ ਗਰਮੀ ਵਿੱਚ ਗੱਲ ਕਰੀਏ ਤਾਂ ਆਪਾਂ ਨੂੰ ਗਰਮੀ ਵਿੱਚ ਦੌੜਨਾ ਸਮੇਂ ਠੰਢੇ ਅਤੇ ਆਰਾਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਦੌੜਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਾਣੀ ਪੀਣਾ ਚਾਹੀਦਾ ਗਰਮੀਆਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਪਾਣੀ ਆਪਾਂ ਪਸੀਨੇ ਪੀਂਦੇ ਹਾਂ ਉਹ ਪਸੀਨੇ ਰਾਹੀਂ ਬਾਹਰ ਆ ਜਾਂਦਾ ਅਤੇ ਜੇਕਰ ਦੌੜੀਏ ਦਾ ਆਪਾਂ ਨੂੰ ਕਿਸੇ ਛਾਂ ਵਾਲੀ ਜਗ੍ਹਾ 'ਤੇ ਦੌੜਨਾ ਚਾਹੀਦਾ ਜੇਕਰ ਮੌਸਮ ਜ਼ਿਆਦਾ ਹੀ ਗਰਮ ਹੋਵੇ ਤਾਂ ਆਪਾਂ ਨੂੰ ਦੌੜਨਾ ਵੀ ਛੱਡ ਦੇਣਾ ਚਾਹੀਦਾ ਜੇਕਰ ਆਪਾਂ ਬਰਸਾਤ ਵਿੱਚ ਦੌੜਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਲ ਪ੍ਰਤਿਰੋਧ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਜੇਕਰ ਜਿਹਦੇ ਗਿੱਲੀਆਂ ਥਾਵਾਂ ਉਹਨਾਂ ਦਾ ਫਿਸਲਣ ਤੋਂ ਆਪਾਂ ਨੂੰ ਆਪਦਾ ਬਚਾਅ ਕਰਨਾ ਚਾਹੀਦਾ ਹੈ ਦੌੜਨ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਲੈ ਲੈਣੀ ਚਾਹੀਦੀ ਹੈ ਕਿ ਮੌਸਮ ਕਿਸ ਤਰ੍ਹਾਂ ਅਗਰ ਜ਼ਿਆਦਾ ਬਰਸਾਤ ਵਾਲਾ ਤਾਂ ਆਪਾਂ ਨੂੰ ਨਹੀਂ ਦੌੜਨਾ ਚਾਹੀਦਾ ਅਗਰ ਥੋੜ੍ਹੀ ਬਰਸਾਤ ਹੈ ਤਾਂ ਆਪਾਂ ਨੂੰ ਦੌੜ ਲੈਣਾ ਚਾਹੀਦਾ ਹੈ ਜੇਕਰ ਜ਼ਿਆਦਾ ਬਰਸਾਤ ਹੋਵੇ ਤਾਂ ਆਪਾਂ ਨੂੰ ਦੌੜਨਾ ਛੱਡ ਦੇਣਾ ਚਾਹੀਦਾ ਜਿਹੜੇ ਆਮ ਸੁਝਾਅ ਨੇ ਦੌੜਨ ਤੋਂ ਪਹਿਲਾਂ ਵਾਮਅਪ ਜ਼ਰੂਰ ਕਰਨਾ ਚਾਹੀਦਾ ਕਿ ਜਿਸ ਨਾਲ ਸਰੀਰ ਵਿੱਚ ਥੋੜ੍ਹੀ ਗਰਮਾਹਟ ਆ ਜਾਂਦੀ ਤਾਂ ਆਪਾਂ ਨੂੰ ਭੱਜਣ ਵਿੱਚ ਮੁਸ਼ਕਿਲ ਨਹੀਂ ਹੁੰਦੀ ਦੌੜਨ ਤੋਂ ਪਹਿਲਾਂ ਅਤੇ ਦੌੜਨ ਤੋਂ ਬਾਅਦ ਵੀ ਸਟਰੈਚਿੰਗ ਅਤੇ ਕਸਰਤ ਕਰਨੀ ਚਾਹੀਦੀ ਹੈ ਅਤੇ ਆਪਾਂ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਪਾਣੀ ਪੀਣਾ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸਰੀਰ ਲਈ ਪਾਣੀ ਹੀ ਮੁੱਖ ਅੰਗ ਹੈ ਆਪਣੀ ਸਿਹਤ ਦਾ ਜੋ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਖਾਣ ਪੀਣ 'ਤੇ ਵੀ ਸਰੀਰ ਧਿਆਨ ਰੱਖਣਾ ਚਾਹੀਦਾ ਕਿ ਆਪਣਾ ਖਾਣ ਪੀਣ ਵਧੀਆ ਹੋਵੇ ਜਿਸ ਨਾਲ ਆਪਣੀ ਦੌੜ ਵਧੀਆ ਲੱਗ ਸਕੇ